ਲਸਣ ਅਦਰਕ ਪਿਆਜ਼ ਅਤੇ ਟਮਾਟਰ ਪਾ ਕੇ ਉਸਦਾ ਤੜਕਾ ਲਗਾਵਾਂਗੇ ਉਸ ਵਿੱਚ ਅਸੀਂ ਆਪਣੇ ਸਵਾਦ ਦੇ ਅਨੁਸਾਰ ਮਿਰਚ ਅਤੇ ਹੋਰ ਕੋਈ ਵੀ ਮਸਾਲਾ ਪਾ ਸਕਦੇ ਹਾਂ ਇਸ ਤੋਂ ਬਾਅਦ ਤੜਕੇ ਨੂੰ ਸਾਗ ਵਿੱਚ ਪਾ ਕੇ ਫਿਰ ਚੰਗੀ ਤਰ੍ਹਾਂ ਰਿਝਾਉ ਜਦੋਂ ਸਾਗ ਚੰਗੀ ਤਰ੍ਹਾਂ ਬਣ ਜਾਵੇ ਰਿੱਝ ਜਾਵੇ ਤਾਂ ਉਸਨੂੰ ਅਸੀਂ ਚੁੱਲ੍ਹੇ ਉੱਪਰੋਂ ਉਤਾਰ ਸਕਦੇ ਹਾਂ ਇਸ ਤੋਂ ਬਾਅਦ ਕੌਲੀ ਵਿੱਚ ਘਿਉ ਪਾ ਕੇ ਮੱਕੀ ਦੀ ਰੋਟੀ ਨਾਲ ਸਾਗ ਖਾਣਾ ਇੱਕ ਬਹੁਤ ਹੀ ਲਾਜਵਾਬ ਹੁੰਦਾ ਹੈ